ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਹਰ ਡਾਟਾ ਇੰਟਰਨੈੱਟ 'ਤੇ ਪਿਆ ਹੈ ਤਾਂ ਇੰਟਰਨੈੱਟ ਕਨੈਕਸ਼ਨ ਨੂੰ ਸਭ ਤੋਂ ਪਹਿਲਾਂ ਸਕਿਓਰ ਕਰਨ ਲਈ ਹੀ ਕਾਫੀ ਚੀਜ਼ਾਂ ਆ ਚੁੱਕੀਆਂ ਹਨ ਸਭ ਤੋਂ ਪਹਿਲੀ ਚੀਜ਼ ਹੈ ਜੋ ਕਿ ਐਂਟੀ ਵਾਇਰਸ ਸੋਫਟਵੇਅਰ ਹੈ ਜੋ ਐਂਟੀ ਵਾਇਸ ਸੋਫਟਵੇਅਰ ਜੇ ਅਸੀਂ ਆਪਣੇ ਕੰਪਿਊਟਰ ਵਿੱਚ ਰੱਖਣ ਤਾਂ ਸਾਡਾ ਡਾਟਾ ਸਕਿਓਰ ਰਹਿੰਦਾ ਹੈ ਜਿਵੇਂ ਕਿ ਅਗਰ ਕਿਸੇ ਹੋਰ ਅਣਪਣਛਾਤੀ ਵੈਬਸਾਈਟ 'ਤੇ ਜਾ ਕੇ ਕਲਿੱਕ ਕਰਨ ਜੋ ਕਲਿੱਕ ਕਰਨ ਨਾਲ ਸਾਡੇ ਕੰਪਿਊਟਰ ਵਿੱਚ ਵਾਇਰਸ ਪਾ ਦਿੰਦਾ ਹੈ ਜਿਸ ਕਰਕੇ ਸਾਡਾ ਡਾਟਾ ਡਾਟਾ ਨਿਕਲ ਜਾਂਦਾ ਹੈ ਤਾਂ ਉਸ ਡਾਟਾ ਨੂੰ ਸੰਭਾਲਣ ਲਈ ਐਂਟੀ ਵਾਇਰਸ ਯੂਜ਼ ਕੀਤਾ ਜਾਂਦਾ ਹੈ